ਭੰਗੜਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਭੰਗੜਾ ਆਪਣਾ ਪੰਜਾਬੀ ਵਿਰਸਾ ਹੈ ਜਿਹੜਾ ਭੰਗੜੇ ਤੋਂ ਬਿਨਾਂ ਕੋਈ ਵੀ ਫੰਕਸ਼ਨ ਨਹੀਂ ਹੁੰਦਾ ਅਤੇ ਅੱਜ ਕੱਲ੍ਹ ਭੰਗੜੇ ਨੂੰ ਵਰਕਆਊਟ ਵਗੈਰਾ ਵਿੱਚ ਵੀ ਜਿਵੇਂ ਆਪਣੇ ਹੈਲਥ ਨੂੰ ਲੈ ਕੇ ਵਰਕਆਊਟ ਵਗੈਰਾ ਕਰਵਾਈ ਦਾ ਉਹਦੇ ਵਿੱਚ ਵੀ ਇਹਦੇ ਕਾਫ਼ੀ ਯੂਜ਼ ਹੋ ਰਿਹਾ ਜਿਵੇਂ ਅੱਜ ਜਿਵੇਂ ਹੁਣ ਸਾਡੇ ਵੀ ਮੋਰਨਿੰਗ ਈਵਨਿੰਗ ਸੈਸ਼ਨ ਚੱਲਦੇ ਆ ਵਰਕਆਊਟ ਵਗੈਰਾ ਦੇ ਤਾਂ ਉਹਦੇ 'ਚ ਕੀ ਹੁੰਦਾ ਵੀ ਹਰ ਵਨ ਵੀਕ 'ਚ ਇੱਕ ਦਿਨ ਪੂਰਾ ਅਸੀਂ ਜਿਵੇਂ ਭੰਗੜਾ ਵਰਕਆਊਟ ਰੱਖਦੇ ਹੈ ਜਿਵੇਂ ਵੀ ਕੈਲਰੀ ਵਗੈਰਾ ਬਰਨ ਕਰਨ ਨੂੰ ਇਸ ਨਾਲ ਇੱਕ ਤਾਂ ਇਹ ਹੈ ਵੀ ਜੋ ਵੀ ਜਿਹੜੀ ਡੇਲੀ ਵਰਕਆਊਟ ਕਰਦੇ ਉਹ ਬੋਰ ਨਹੀਂ ਹੁੰਦੇ ਇੰਟਰਸਟਿੰਗ ਲੱਗਦਾ ਹੈ ਤਾਂ ਦੂਸਰਾ ਉਹਨਾਂ ਦਾ ਫ਼ਾਇਦਾ ਹੁੰਦਾ ਵੀ ਕੈਲਰੀ ਵਗੈਰਾ ਬਰਨ ਹੁੰਦੀ ਹੈ ਤਾਂ ਜਿਹੜਾ ਅਰਬਿਕ ਭੰਗੜਾ ਵਰਕਆਊਟ ਹੈ ਉਹਦੇ 'ਚ ਕੀ ਹੁੰਦਾ ਵੀ ਸਾਨੂੰ ਪੂਰੀ ਬਾਡੀ ਦੇ ਪਾਰਟ ਪੂਰੇ ਮਿਊਜ਼ਿਕ ਦੇ ਨਾਲ ਹੀ ਕਰਨੇ ਪੈਂਦੇ ਆ ਵੀ ਜਿਸ ਤਰ੍ਹਾਂ ਹੈਵੀ ਬੇਸ ਦੇ ਨਾਲ ਕਰਨੇ ਪੈਂਦੇ ਹੈ ਜਿਵੇਂ ਮਿਊਜਿਕ ਕਾਫ਼ੀ ਹੈਵੀ ਜਿਹਾ ਚੱਲਦਾ ਤਾਂ ਉਸ ਤਰ੍ਹਾਂ ਪੂਰੀ ਬਾਡੀ ਸਾਡੀ ਵੀ ਕਰਦੀ ਹੈ ਜਿਸ ਤਰ੍ਹਾਂ ਸਾਡੇ ਵੀ ਵਰਕਆਊਟ ਵਗੈਰਾ ਕਰਦੇ ਐਂ ਤਾਂ ਚਾਹੇ ਸਾਰੀ ਬਾਡੀ ਦੇ ਪਾਰਟ ਵਗੈਰਾ ਸਹੀ ਚਲਦੇ ਹੈ ਹੱਥ ਪੈਰ ਬਰਾਬਰ ਉਹਦੇ ਵੱਲ ਅਕੋਰਡਿੰਗ ਚਲਾਉਣੇ ਪੈਂਦੇ ਆ ਮਿਊਜਿਕ ਦੇ ਤਾਂ ਵਰਕਆਊਟ ਜਦੋਂ ਕਰਦੇ ਹਾਂ ਉਹ ਥੋੜ੍ਹਾ ਜਿਹਾ ਅਲੱਗ ਸਟਾਈਲ ਹੁੰਦਾ ਹੈ ਵੀ ਉਹਦੇ 'ਚ ਕੀ ਹੁੰਦਾ ਵੀ ਅਸੀਂ ਆਪਣੇ ਲੱਤਾਂ ਵਗੈਰਾ ਜਿਵੇਂ ਕਰਕੇ ਸਿੱਧੀਆਂ ਤਾਂ ਫਿਰ ਹੱਥ ਪੈਰ ਵਗੈਰਾ ਚਲਾਉਂਦੇ ਹਾਂ ਇਹਦੇ 'ਚ ਪੂਰਾ ਲੱਤਾਂ ਵਗੈਰਾ ਜੋੜ ਕੇ ਕਮਰ ਵਗੈਰਾ ਬਾਜੂ ਸਾਰਾ ਕੁਛ ਵੀ ਬਰਾਬਰ ਪੂਰੀ ਬਾਡੀ ਏ ਹਿਲਦੀ ਹੈ ਇਹਦੇ ਵਿੱਚ ਤਾਂ ਜਿਹੜਾ ਭੰਗੜਾ ਵਰਕਆਊਟ ਹੈ ਉਹ ਥੋੜ੍ਹਾ ਜਿਹਾ ਆਸਾਨ ਹੋ ਜਾਂਦਾ ਉਹਦੇ 'ਚ ਇਸ ਤਰ੍ਹਾਂ ਹੁੰਦਾ ਵੀ ਆਪਾਂ ਭੰਗੜੇ ਵਾਲੇ ਹੀ ਵਰਕ ਜੋ ਵੀ ਪਾਰਟ ਹੁੰਦੇ ਹੈ ਜੋ ਵੀ ਸਟੈਪ ਹੁੰਦੇ ਉਹ ਯੂਜ ਕਰ ਸਕਦੇ ਆ ਉਹਨੂੰ ਜਿਵੇਂ ਮਰਜ਼ੀ ਜਿਸ ਤਰ੍ਹਾਂ ਆਪਾਂ ਨੂੰ ਮਨ ਕਰਦਾ ਮਿਊਜਿਕ ਨਾਲ ਜਿਸ ਤਰ੍ਹਾਂ ਪੈਰ ਉਠਦਾ ਏ ਆਪਾਂ ਉਸੇ ਤਰ੍ਹਾਂ ਹੀ ਕਰ ਸਕਦੇ ਹਾਂ ਤੇ ਜਿਹੜਾ ਅਰੇਬਿਕ ਹੁੰਦਾ ਇਹਨੂੰ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਟਾਈਪ ਕਹਿ ਸਕਦੇ ਹਾਂ ਵੀ ਪ੍ਰੋਫੈਸ਼ਨਲ ਹੁੰਦਾ ਇਹ ਵਰਕਆਊਟ ਵੀ ਜੋ ਪ੍ਰੋਫੈਸ਼ਨਲ ਬੰਦਾ ਹੈ ਉਹ ਹੀ ਜ਼ਿਆਦਾ ਉਹਨੂੰ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਨੋਰਮਲ ਆਪਣੇ ਤੋਂ ਉਸ ਤਰ੍ਹਾਂ ਨਹੀਂ ਹੁੰਦਾ ਗਾ ਸੋ ਇਸ ਕਰਕੇ ਇਹਨਾਂ ਦੋਵਾਂ 'ਚ ਇਹ ਹੀ ਡਿਫਰੇਨਸ ਹੁੰਦਾ ਵੀ ਜਿਹੜਾ ਭੰਗੜਾ ਵਰਕਆਊਟ ਆ ਉਹ ਨੋਰਮਲ ਜਿਹੜਾ ਮਰਜ਼ੀ ਬੰਦਾ ਜਿਸ ਮਰਜ਼ੀ ਆਪਣੇ ਆਪਣੀ ਇੱਛਾ ਅਨੁਸਾਰ ਆ ਤੁਸੀਂ ਕਿਵੇਂ ਕਰ ਸਕਦੇ ਓਂ ਔਰ ਐਰੇਬਿਕ 'ਚ ਇਸ ਤਰ੍ਹਾਂ ਵੀ ਪ੍ਰੋਫੈਸ਼ਨਲ ਹੈ ਜੋ ਉਹ ਹੀ ਅੱਛੀ ਤਰੀਕੇ ਨਾਲ ਕਰਵਾ ਸਕਦੇ ਆ ਸੋ ਥੈਂਕ ਯੂ